ਪਹਿਲਾਂ ਮੈਂ ਜਦੋਂ ਨੋਕਰੀ ਕਰਦਾ ਸੀ ਉਦੋਂ ਤਾਂ ਡਿਊਟੀ ਦਾ ਬੋਝ ਰਹਿੰਦਾ ਸੀ ਅਤੇ ਬੜਾ ਘੱਟ ਫੈਮਲੀ ਨਾਲ ਰਹਿਣ ਦਾ ਸਮਾਂ ਮਿਲਦਾ ਸੀ ਅਤੇ ਹੁਣ ਰਿਟਾਇਰ ਹੋਣ ਤੋਂ ਬਾਅਦ ਮੇਨ ਚੀਜ਼ ਹੈ ਗੁਰਬਾਣੀ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਬਾਣੀ ਸੁਣਨੀ ਅਤੇ ਉਹਨਾਂ 'ਤੇ ਵਿਚਾਰ ਕਰਨੀ ਅਤੇ ਉਹਦੇ ਘਰ ਆ ਕੇ ਆਪਣੇ ਪੋਤੇ ਨਾਲ ਖੇਲਣਾ ਅਤੇ ਉਹਨੂੰ ਸਕੂਲ ਲੈ ਕੇ ਜਾਣਾ ਅਤੇ ਲੈ ਕੇ ਆ ਜਾਣਾ ਅਤੇ ਸ਼ਾਮ ਨੂੰ ਉਹਨੂੰ ਪਾਰਕ ਦੇ ਵਿੱਚ ਲੈ ਕੇ ਜਾਣਾ ਇਹੀ ਮੇਨ ਚੀਜ਼ ਸਾਨੂੰ ਖੁਸ਼ ਰੱਖਦੀ ਆ